ਭਾਰਤ ਵਿੱਚ ਮੁੱਖ ਧਾਰਮਿਕ ਸਥਾਨ ਅੰਮ੍ਰਿਤਸਰ ਹੈ ਅੰਮ੍ਰਿਤਸਰ ਹੈ ਜਿੱਥੇ ਲੋਕ ਬਹੁਤ ਜ਼ਿਆਦਾ ਜਾਂਦੇ ਨੇ ਅਤੇ ਬਹੁਤ ਇੱਥੇ ਲੋਕ ਜਿਹੜੇ ਲੋਕ ਹੈ ਉਹ ਬਾਹਰੋਂ ਤੋਂ ਵੀ ਆਉਂਦੇ ਆ ਅਤੇ ਜਿਹੜੇ ਭਾਰਤ ਦੇ ਲੋਕ ਹੈ ਉ ਉਹ ਵੀ ਉੱਥੇ ਮੱਥਾ ਟੇਕਣ ਜਾਂਦੇ ਨੇ ਅਤੇ ਲੋਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਉੱਥੇ ਮੱਥਾ ਟੇਕ ਦੇ ਹਨ ਅਤੇ ਉੱਥੇ ਬਹੁਤ ਹੀ ਜ਼ਿਆਦਾ ਰੱਸ਼ ਹੁੰਦਾ ਏ ਜਿੱਥੇ ਇਹ ਵੈਸੇ ਹੋਰ ਦਿਨਾਂ ਵਿੱਚ ਵੀ ਰੱਸ਼ ਰਹਿੰਦਾ ਏ ਪਰ ਜ਼ਿਆਦਾ ਦੀਵਾਲੀ ਦੇ ਦਿਨ ਵਿੱਚ ਬਹੁਤ ਹੀ ਜ਼ਿਆਦਾ ਰੱਸ਼ ਹੁੰਦਾ ਏ ਅਤੇ ਉੱਥੇ ਲੋਕਾਂ ਦੀ ਸ਼ਰਧਾ ਭਾਵਨਾ ਬਹੁਤ ਹੈ